ਮੈਂ ਇੱਕ ਮੀਸ਼ੋ ਐਪ 'ਤੇ ਇੱਕ ਸ਼ਰਟ ਓਡਰ ਕੀਤੀ ਹੈ ਉਸ ਦਾ ਰੰਗ ਬਹੁਤ ਹੀ ਸੋਹਣਾ ਹੈ ਮੈਨੂੰ ਬਹੁਤ ਹੀ ਪਸੰਦ ਹੈ ਜਦੋਂ ਮੈਂ ਫੰਕਸਨ ਵਿੱਚ ਪਾ ਕੇ ਗਈ ਮੇਰੀ ਸਹੇਲੀਆਂ ਨੇ ਦੱਸਿਆ ਕਿ ਕਿੱਥੋਂ ਓਡਰ ਕੀਤਾ ਹੈ ਮੈਂ ਕਿਹਾ ਮੀਸੋ ਤੋਂ ਓਡਰ ਕੀਤੀ ਹੈ ਅਤੇ ਉਹ ਬੋਲੀ ਮੇਰੀ ਵੀ ਕਰਾ ਦੇ ਮੀਸ਼ੋ ਐਪ ਤੋਂ ਫਿਰ ਮੇਰੀ ਸਹੇਲੀ ਨੇ ਮੀਸ਼ੋ ਐਪ ਤੋਂ ਇੱਕ ਸਰਟ ਓਡਰ ਕਰਵਾਈ ਅਤੇ ਉਹ ਪੰਜ ਦਿਨਾਂ ਵਿੱਚ ਦੇ ਗਿਆ ਉਸ ਨੂੰ ਵੀ ਉਸਦਾ ਰੰਗ ਪਸੰਦ ਆਇਆ ਨਾਲੇ ਉਹ ਡਿਰੈਵਰੀ ਵਾਲੇ ਨੂੰ ਥੈਂਕਸ ਬੋਲ ਦ ਦਿੱਤਾ ਅਤੇ ਮੇਰੀ ਸਹੇਲੀ ਜਿਹੜੀ ਸੀ ਉਸ ਨੇ ਇੱਕ ਲਹਿੰਗਾ ਵੀ ਓਡਰ ਕਰਾਇਆ ਸੀ ਅਤੇ ਮੇਰੇ ਭਾਈ ਨੇ ਇੱਕ ਸਲਟ ਓਡਰ ਕਰਾਈ ਉਸ ਨੂੰ ਵੀ ਪਸੰਦ ਲੱਗੀ ਅਤੇ ਸਾਰੇ ਪਰਿਵਾਰ ਨੂੰ ਵੀ ਸੋਹਣੀ ਲੱਗੀ